ਹੈਲੋ ਦੀਦੀ ਸਤਿ ਸ਼੍ਰੀ ਅਕਾਲ ਬਸ ਕੰਮਾਂ ਕਾਰਾਂ 'ਚ ਕਿਹੜਾ ਟਾਈਮ ਲੱਗਦਾ ਹਾਂਜੀ ਘਰ ਸਭ ਵਧੀਆ ਬਸ ਸਭ ਵਧੀਆ ਨੇ ਅੱਛਾ ਹੁਣ ਆਪਣੇ ਬੱਚਿਆਂ ਦੇ ਆਪਾਂ ਜਿੱਦਾਂ ਟੈਨਥ ਤੋਂ ਬਾਅਦ ਸਕੂਲ ਚੇਂਜ ਕਰਨਾ ਸੀ ਤੁਸੀਂ ਸੋਚਿਆ ਕੁਝ ਇਸ ਬਾਰੇ ਹਾਂਜੀ ਮੈਂ ਵੀ ਐਮ ਆਰ ਬਾਰੇ ਪਤਾ ਕੀਤਾ ਸੀਗਾ ਬਟ ਏ ਵੈਸੇ ਕੋਲੇਜ ਤਾਂ ਸਾਡੇ ਲੌਕੈਲਿਟੀ ਦੇ ਵਿੱਚ ਬਹੁਤ ਸਾਰੇ ਨੇ ਐਮ ਆਰ ਸੀ ਪੀ ਵੀ ਹੈ ਸਾਡੇ ਕੋਲ਼ ਨੌਰਵੁੱਡ ਵੀ ਹੈ ਨਵਾਂ ਖੁੱਲ੍ਹਿਆ ਹੋਇਆ ਮਾਊਂਟ ਕਾਰਮਲ ਹੈ ਜਿਹੜਾ ਕਿ ਉਹ ਕੌਨਵੈਂਟ ਸਕੂਲ ਹੈ ਸਾਡੇ ਕੋਲ ਚੋਇਸਿਜ਼ ਤਾਂ ਹੈਗੀਆਂ ਨੇ ਤੁਸੀਂ ਵੈਸੇ ਪਤਾ ਕੀਤਾ ਇਹਨਾਂ ਦੇ ਬਾਰੇ ਕੁਝ

ਠੀਕ ਹੈ ਪਰ ਮੈਨੂੰ ਇੱਦਾਂ ਲੱਗਦਾ ਕਿ ਜਿੱਦਾਂ ਐਮ ਆਰ ਦੇ ਵਿੱਚ ਨਾ ਬੱਚੇ ਕਾਫ਼ੀ ਹੁੰਦੇ ਨੇ ਅਤੇ ਮਤਲਬ ਬਹੁਤ ਜ਼ਿਆਦਾ ਜਦੋਂ ਇੱਕ ਕਲਾਸ ਦੇ ਵਿੱਚ ਬੱਚੇ ਹੋ ਜਾਂਦੇ ਨੇ ਤਾਂ ਜਿਹੜੇ ਟੀਚਰ ਹੈ ਨਾ ਬਹੁਤ ਘੱਟ ਧਿਆਨ ਦੇ ਪਾਉਂਦੇ ਨੇ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਸਾਨੂੰ ਨੌਰਵੁੱਡ ਦੇ ਵਿੱਚ ਟਰਾਈ ਕਰ ਲੈਣਾ ਚਾਹੀਦਾ ਹੈ ਕਿਉਂਕਿ ਉੱਥੇ ਦੀਆਂ ਮੈਂ ਦੇਖਿਆ ਹੋਇਆ ਅਗਰ ਜਿੱਦਾਂ ਟ੍ਰਾਸਪੋਰਟੇਸ਼ਨ ਦਾ ਵੀ ਪੂਰਾ ਪ੍ਰਬੰਧ ਹੈ ਬੱਚਿਆਂ ਨੂੰ ਕੋਈ ਤਕਲੀਫ਼ ਵਗੈਰਾ ਨਹੀਂ ਹੋਵੇਗੀ ਹਾਂਜੀ ਠੀਕ ਹੈ ਹਾਂਜੀ ਪਲੀਜ਼ ਤੁਸੀਂ ਉਹਨਾਂ ਨੂੰ ਹਨਾਂ ਪੁੱਛ ਲਿਓ ਵੈਸੇ ਫ਼ੀਸ ਸਟੱਕਚਰ ਵਗੈਰਾ ਦਾ ਤਾਂ ਉਹਨਾਂ ਦਾ ਜਿਹੜਾ ਪੈਮਪਲੇਟ ਜਿਹਾ ਹੁੰਦਾ ਮੈਂ ਵੀ ਦੇਖਿਆ ਸੀ ਫ਼ੀਸ ਤਾਂ ਉਹਨਾਂ ਨੇ ਨੋਮੀਨਲ ਹੈ ਕਿ ਸੱਤ ਕੁ ਹਜ਼ਾਰ ਰੁਪਇਆ ਪਰ ਮੰਥ ਜਿਹੜਾ ਕਿ ਸਾਡੇ ਬੱਚਿਆਂ ਦੇ ਲਈ ਠੀਕ ਹੈ ਹਾਂਜੀ ਮੈਨੂੰ ਲੱਗਦਾ ਸਾਨੂੰ ਨੌਰਵੁੱਡ ਅਤੇ ਇੱਕ ਵਾਰ ਮਾਊਂਟ ਕਾਰਮਲ ਦੇ ਬਾਰੇ ਵੀ ਨਾ ਦੇਖ ਲੈਣਾ ਚਾਹੀਦਾ ਠੀਕ ਹੈ ਤੁਸੀਂ ਨਾ ਇਹ ਸਭ ਪੁੱਛ ਕੇ ਮੈਨੂੰ ਜ਼ਰੂਰ ਡੀਟੇਲ 'ਚ ਨਾ ਫੌਰਵਰਡ ਕਰ ਦਿਓ ਠੀਕ ਹੈ ਦੀਦੀ